ਕੀ ਤੁਸੀਂ ਸਵੀਗੀ ਤੋਂ ਬੋਲ ਰਹੇ ਹੋ ਮੈਂ ਆਪਣਾ ਇੱਕ ਔਡਰ ਪਲੇਸ ਕੀਤਾ ਸੀਗਾ ਜਿਹਦੇ ਵਿੱਚ ਕਿ ਦੋ ਬਰਗਰ ਇੱਕ ਫਰੈਂਚ ਫਰਾਈਜ ਸੀਗੇ ਅਤੇ ਉਸ ਦੀ ਪੇਮੈਂਟ ਮੈਂ ਪੇਟੀਐੱਮ ਤੋਂ ਕਰ ਤੀ ਵੀ ਹੈ ਅਤੇ ਕੀ ਤੁਸੀਂ ਦੇਖ ਕੇ ਦੱਸ ਸਕਦੇ ਹੋ ਵੀ ਪੇਮੈਂਟ ਰਿਸੀਵ ਹੋ ਗਈ ਹੈ ਤੁਹਾਨੂੰ ਜਾਂ ਨਹੀਂ